ਹੈਲੋ ਮੈਮ ਤੁਸੀਂ ਕਲੱਬ ਕੋ ਯੁਵਾ ਕਲੱਬ ਕੋਆਡੀਨੇਟਰ ਜ ਜਸਵੀਰ ਕੌਰ ਬੋਲ ਰਹੇ ਹੋ ਮੈਂ ਜੈਸਮੀਨ ਬੁੰਗਿਆਂ ਤੋਂ ਮੈਮ ਮੈਂ ਆਪਣੀ ਬੇਟੀ ਨੂੰ ਲਗਾਉਣਾ ਸੀ ਤੁਹਾਡੇ ਕਲੱਬ 'ਚ ਅਤੇ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਤੁਹਾਡੇ ਕਲੱਬ ਦੀਆਂ ਐਕਟੀਵੀਟੀਜ਼ ਕੀ ਹੈ ਅਤੇ ਇਹਦੀ ਟਾਈਮਿੰਗ ਕੀ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਡਾਂਸ ਦਾ ਵੀ ਹੈ ਠੀਕ ਹੈ ਤੁਹਾਡੇ ਚਾਰਜਿਜ਼ ਕੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ